ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਦੁਆਰਾ ਲਈ ਗਈ ਹੈ ਗੁਰਮੁਖੀ ਭਾਵ ਗੁਰੂਆਂ ਦੁਆਰਾ ਬੋਲੀ ਗਈ ਜਾਂ ਉਚਾਰੀ ਗਈ ਜਿਸ ਦਾ ਕਿ ਹੋਰ ਭਾਸ਼ਾ ਬੋਡੋ ਬੰਗਾਲੀ ਨਾਲ਼ ਕੋਈ ਵੀ ਸੰਬੰਧ ਨਹੀਂ ਹੈ ਪੰਜਾਬੀ ਇੱਕ ਅਜੋਕੀ ਭਾਸ਼ਾ ਹੈ ਜਿਸ ਦੇ ਕਈ ਅੱਗੇ ਉਪਭਾਸ਼ਾਵਾਂ ਵੀ ਹਨ ਜਿਵੇਂ ਕਿ ਮਾਝੇ ਦੇ ਇਲਾਕੇ ਦੇ ਵਿੱਚ ਅਲੱਗ ਭਾਸ਼ਾ ਬੋਲੀ ਜਾਂਦੀ ਹੈ ਦੁਆਬੇ ਇਲਾਕੇ ਵਿੱਚ ਅਲੱਗ ਭਾਸ਼ਾ ਬੋਲੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਦਾ ਕਿਸੇ ਹੋਰ ਭਾਸ਼ਾ ਨਾਲ਼ ਕੋਈ ਸੰਬੰਧ ਨਹੀਂ ਹੈ ਇਸ ਇਸਦਾ ਸੰਬੰਧ ਗੁਰਮੁਖੀ ਲਿਪੀ ਨਾਲ਼ ਹੈ